ਇਹ ਗੱਲ ਬਿਲਕੁਲ ਸਹੀ ਆ ਵੀ ਪਿੰਡਾਂ ਦੇ ਵਿੱਚ ਜੀਵਨ ਸਾਥੀ ਪ੍ਰਾਪਤ ਕਰਨ ਲਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਆਉਣ ਜਾਣ ਲਈ ਸੁੱਖ ਸੁਵਿਧਾਵਾਂ ਨਹੀਂ ਹਨ ਰਸਤੇ ਸਹੀ ਨਹੀਂ ਹਨ ਕੱਚੇ ਰਸਤੇ ਹਨ ਭਾਵੇਂ ਸਰਕਾਰਾਂ ਇਸ 'ਤੇ ਕੰਮ ਕਰ ਰਹੀਆਂ ਹਨ ਪਰ ਫਿਰ ਵੀ ਸ਼ਹਿਰਾਂ ਜਿੰਨੀ ਜਿਹੜੀ ਫੈਸਿਲਿਟੀ ਆ ਉਹ ਨਹੀਂ ਮਿਲ ਰਹੀ ਸ਼ਹਿਰਾਂ ਦੇ ਵਿੱਚ ਹਰ ਇੱਕ ਚੀਜ਼ ਸੌਖੀ ਪ੍ਰਾਪਤ ਹੋ ਜਾਂਦੀ ਆ ਜਿਵੇਂ ਸਾਧਨਾਂ ਨੂੰ ਲੈ ਕੇ ਲਾ ਲਓ ਜਾਂ ਜਿਵੇਂ ਸਿੱਖਿਆ ਨੂੰ ਲੈ ਕੇ ਲਾ ਲਓ ਸਕੂਲਾਂ ਨੂੰ ਅਲੱਗ ਲੈ ਕੇ ਸ਼ਹਿ ਪਿੰਡਾਂ ਦੇ ਵਿੱਚ ਸਕੂ ਸਕੂਲਾਂ ਦਾ ਪ੍ਰਬੰਧ ਉਹ ਜਿਹਾ ਨਹੀਂ ਹੈ ਜਿਹੋ ਜਿਹਾ ਸ਼ਹਿਰਾਂ ਦੇ ਵਿੱਚ ਹੈ ਜਿਵੇਂ ਸਿਹਤ ਸੰਬੰਧੀ ਲਾ ਲਓ ਵੀ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਅੱਜ ਕੱਲ੍ਹ ਹੋਸਪਿਟਲ ਆ ਅਤੇ ਪਿੰਡਾਂ ਦੇ ਵਿੱਚ ਉਹ ਜਿਹੇ ਹਸਪਤਾਲ ਮੌਜੂਦ ਨਹੀਂ ਹਨ ਇਸ ਲਈ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ਹਿਰਾਂ ਦੇ ਵਿੱਚ ਹੋਰ ਵਧੀਆ ਜਿਵੇਂ ਖੇਡਾਂ ਨੂੰ ਲੈ ਕੇ ਲਾ ਲਓ ਹਰ ਇੱਕ ਤਰ੍ਹਾਂ ਦੇ ਅਲੱਗ ਅਲੱਗ ਗਰਾਊਂਡ ਬਣੇ ਹੋਏ ਆ ਅਤੇ ਵਧੀਆ ਗੇਮਾਂ ਵੀ ਆ ਸ਼ਹਿਰਾਂ ਦੇ ਵਿੱਚ ਮ ਕੀ ਹਰੇਕ ਚੀਜ਼ ਹਰੇਕ ਕੋਈ ਵੀ ਫੈਸਿਲਿਟੀ ਆ ਜਿਹੜੀ ਸ਼ਹਿਰਾਂ ਦੇ ਵਿੱਚ ਮੌਜੂਦ ਆ ਹਰ ਟਾਈਮ